ਸਤਿ ਸ਼੍ਰੀ ਅਕਾਲ ਜੀ ਤੁਸੀਂ ਟੈਕਸੀ ਡਰੈ ਸਟੈਂਡ ਤੋਂ ਬੋਲਦੇ ਹੋ ਪਰਸੋਂ ਅਸੀਂ ਦਰਬਾਰ ਸਾਹਿਬ ਜਾਣਾ ਹੈ ਤੁਸੀਂ ਵੇਹਲੇ ਹੋ ਅਸੀਂ ਪੰਜ ਛੇ ਫੈਮਲੀ ਮੈਂਬਰਸ ਜਾਵਾਂਗੇ ਜਿਸ ਵਿੱਚ ਮੇਰੇ ਮਾਤਾ ਜੀ ਮਾਤਾ ਪਿਤਾ ਮੇਰੇ ਮੈਂ ਮੇਰੇ ਬ੍ਰਦਰ ਚਾਚਾ ਚਾਇ ਚਾਚੀ ਤਾਇਆ ਤਾਈ ਐਂਡ ਮੇਰੇ ਦਾਦੀ ਜੀ ਹੋਣਗੇ ਸਭ ਤੋਂ ਪਹਿਲਾਂ ਅਸੀਂ ਖਟਖੜ ਕਲਾ ਰੁਕਾਂਗੇ ਜੋ ਕਿ ਸ਼ਹੀਦ ਭਗਤ ਸਿੰਘ ਦਾ ਘਰ ਹੈ ਜਿਸ ਵਿੱਚ ਮਿਊਜ਼ਿਅਮ ਬਣਿਆ ਹੈ ਜੋ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਫਿਰ ਅਸੀਂ ਜਲੰਧਰ ਹਵੇਲੀ ਵਿੱਚ ਰੁਕਾਂਗੇ ਜਿਸ ਵਿੱਚ ਅਸੀਂ ਚਾਹ ਪਾਣੀ ਪੀਵਾਂਗੇ ਫਿਰ ਅਸੀਂ ਦਰਬਾਰ ਸਾਹਿਬ ਜਾਣਾ ਹੈ ਜਿਸ ਵਿੱਚ ਦੋ ਤਿੰਨ ਘੰਟੇ ਮੱਥਾ ਟੇਕਣ ਨੂੰ ਲੱਗ ਜਾਂਦੇ ਹਨ ਫਿਰ ਅਸੀਂ ਲੰਗਰ ਛਕਾਂਗੇ ਅਤੇ ਫਿਰ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਸਾਹਿਬ ਜਾਵਾਂਗੇ ਅਤੇ ਫਿਰ ਫਿਰ ਤਰਨਤਾਰਨ ਜਾਵਾਂਗੇ ਆਉਂਦੇ ਸਮੇਂ ਅਸੀਂ ਹਵੇਲੀ ਵਿੱਚ ਰੁਕਾਂਗੇ ਜਿਸ ਵਿੱਚ ਅਸੀਂ ਚਾਹ ਪਾਣੀ ਪੀਵਾਂਗੇ ਫਿਰ ਟੱਲਨ ਸਾਹਿਬ ਟੱਲਨ ਸਾਹਿਬ ਵਿਖੇ ਮੱਥਾ ਟੇਕਾਂਗੇ ਆਉਂਦੇ ਵਕਤ ਰਾਜਾ ਸਾਹਿਬ ਜੋ ਕਿ ਰਾਂਹੂ ਰਾਹੋਂ ਰੋਡ 'ਤੇ ਪੈਂਦਾ ਹੈ ਨਵਾਂ ਸ਼ਹਿਰ ਦੇ ਵਿੱਚ ਉਸ ਵਿੱਚ ਅਸੀਂ ਮੱਥਾ ਟੇਕਣਾ ਚਾਹੁੰਦੇ ਹਾਂ ਮੇਰਾ ਡ੍ਰੀਮ ਬਾਹਰ ਜਾਣ ਦਾ ਹੈ ਸੋ ਅਸੀਂ ਉਥੇ ਜਹਾਜ਼ ਚੜਾਉਣਾ ਚਾਹੁੰਦੇ ਹਾਂ ਆਉਂਦੇ ਅਸੀਂ ਘਰ ਆ ਕੇ ਟੈਕਸੀ ਟੈਕਸੀ ਡਰਾਈਵਰ ਨੂੰ ਅਡਵਾਂਸ ਪੇਮੈਂਟ ਕਰ ਦਵਾਂਗੇ ਨਾਲ਼ੇ ਹਾਫ ਘਰ ਆ ਕੇ ਦੇ ਦਵਾਂਗੇ ਧੰਨਵਾਦ